ਹੈਲੋ ਦਸ ਦਿਨ ਪਹਿਲਾਂ ਮੈਂ ਫਲਿੱਪਕਾਰਟ ਤੋਂ ਪਰਫਿਊਮ ਮੰਗਵਾਏ ਸੀਗੇ ਜਿਸ ਦੀ ਲਗਭਗ ਕੀਮਤ ਛੇ ਸੌ ਰੁਪਿਆ ਸੀਗਾ ਅਤੇ ਜਦੋਂ ਮੈਨੂੰ ਬੜਾ ਚਾਅ ਸੀਗਾ ਕਿ ਮੈਂ ਪਰਫਿਊਮ ਮੰਗਵਾਏ ਨੇ ਡੈਨਮ ਕੰਪਨੀ ਦੇ ਅਤੇ ਮੈਨੂੰ ਬੜੀ ਖੁਸ਼ੀ ਸੀਗੀ ਮੈਂ ਕਿਹਾ ਬਹੁਤ ਵਧੀਆ ਹੋਣਗੇ ਅਤੇ ਜਦੋਂ ਆਏ ਅਤੇ ਉਹਦੀ ਪੈਕਜਿੰਗ ਫਟੀ ਹੋਈ ਸੀ ਅਤੇ ਮੇਰਾ ਮਨ ਜਿਹਾ ਖਰਾਬ ਹੋਇਆ ਬਹੁਤ ਇਸ ਦੇਖ ਕੇ ਅਤੇ ਜਦੋਂ ਮੈਂ ਉਹ ਖੋਲ੍ਹਿਆ ਤਿੰਨ ਸੀਗੇ ਉਹ ਤਿੰਨਾਂ 'ਚੋਂ ਇੱਕ ਦੀ ਸ਼ੀਸ਼ੀ ਟੁੱਟੀ ਹੋਈ ਦੋਨਾਂ ਦੀ ਸ਼ਕਲ ਬਦਲੀ ਹੋਈ ਦੂਜੇ ਬਾਕੀਆਂ ਦੀ ਕਿ ਜਿਵੇਂ ਬਹੁਤ ਹੀ ਪੁਰਾਣੇ ਹੁੰਦੇ ਆ ਉਹ ਅਤੇ ਮੇਰਾ ਮਨ ਬਹੁਤ ਖਰਾਬ ਹੋਇਆ ਕਿ ਮੈਂ ਪੈਸੇ ਵੀ ਲਾਏ ਅਤੇ ਮੈਨੂੰ ਚੀਜ਼ ਵੀ ਵਧੀਆ ਨਹੀਂ ਮਿਲੀ ਚਲੋ ਮੈਂ ਕਿਹਾ ਚਲੋ ਹੁਣ ਪੈਕਿੰਗ ਕਈ ਵਾਰ ਹੋ ਗਈ ਕੁਛ ਖਰਾਬ ਹੋ ਗਈ ਹੋਣੀ ਆ ਚਲੋ ਮੈਂ ਵਰਤ ਕੇ ਦੇਖ ਲੈਂਦਾ ਜਦੋਂ ਵਰਤ ਕੇ ਲਾਇਆ ਉਹਦੀ ਕੋਈ ਖੁਸ਼ਬੂ ਨਾ ਜਮ੍ਹਾਂ ਭੱਦੀ ਬਦਬੂ ਆ ਰਹੀ ਉਹਦੇ 'ਚੋਂ ਅਤੇ ਮੇਰਾ ਤਜ਼ਰਬਾ ਬਹੁਤ ਹੀ ਮਾੜਾ ਰਿਹਾ ਅਤੇ ਮੈਨੂੰ ਤਾਂ ਮੇਰੇ ਘਰ ਦੇ ਇਸ ਗੱਲ 'ਤੇ ਲੋ ਲੜੇ ਕਿ ਜਦੋਂ ਤੈਨੂੰ ਸ਼ਹਿਰ 'ਚੋਂ ਮਿਲ ਰਹੀ ਸੀ ਚਾਰ ਸੌ ਰੁਪਏ ਚੀਜ਼ ਅਤੇ ਤੂੰ ਛੇ ਸੌ ਦੀ ਲਈ ਅਤੇ ਮੇਰਾ ਬਹੁਤ ਹੀ ਤਜ਼ਰਬਾ ਮਾੜਾ ਹੋਇਆ ਇਸ ਲਈ ਮੇਰਾ ਨੈਗਟਿਵ ਵਿਚਾਰ ਇਹੀ ਹੈ ਕਿ ਮੇਰੇ ਨਾਲ ਇਸ ਤੋਂ ਪਹਿਲਾਂ ਕਦੇ ਨਹੀਂ ਇਹੋ ਜਿਹਾ ਹੋਇਆ ਜਿਹੜਾ ਮੇਰੇ ਇਸ ਪਰਫਿਊਮ ਨੇ ਮੇਰੇ ਨਾਲ ਕੀਤਾ